ਕਸਰਤ ਜਿਹੜੀ ਹੈ ਆਮ ਬੰਦੇ ਲਈ ਮੁਸ਼ਕਿਲ ਹੁੰਦੀ ਹੈ ਕਿਸੇ ਦੇ ਵਿੱਚ ਇਸ ਵਿੱਚ ਰੁਚੀ ਨਹੀਂ ਹੁੰਦੀ ਪਰ ਭੰਗੜਾ ਐਰੋਬਿਕਸ ਵਿੱਚ ਸਾਰੇ ਪ੍ਰਤਿਭਾਗੀ ਆਪਣੀ ਵਧੀਆ ਤਰੀਕੇ ਨਾਲ ਰੁਚੀ ਦਿਖਾਉਂਦੇ ਹਨ ਇਹ ਵਧੀਆ ਤਰੀਕੇ ਨਾਲ ਕਰਦੇ ਹਨ ਸਾਰੇ ਹੀ ਇਹਦੇ ਵਿੱਚ ਆਪਣਾ ਵਧੀਆ ਸ਼ੌਕ ਦਰਸਾਉਂਦੇ ਹਨ ਅਤੇ ਇਹ ਸਾਨੂੰ ਬਹੁਤ ਵਧੀਆ ਲੱਗਦਾ ਹੈ ਧੰਨਵਾਦ